ਹੈਲੋ ਹੈਲੋ ਹਾਂਜੀ ਕਿਵੇਂ ਹੋ ਬਸ ਵਧੀਆ ਕੀ ਦੱਸੀਏ ਮੈਂ ਨਾ ਹੁਣੀ ਜੋਬ ਤੋਂ ਆਈ ਹਾਂ ਤੁਹਾਨੂੰ ਕੀ ਦੱਸਾ ਲੇਟ ਹੋ ਗਈ ਇੰਨੀ ਟਰੈਫਿਕ ਹੈ ਨਾ ਆਪਣੇ ਪਟਿਆਲੇ 'ਚ ਤਾਂ ਹੋਰ ਕੀ ਪਹਿਲਾਂ ਠੀਕ ਸੀ ਜਦੋਂ ਪੁਰਾਣਾ ਬੱਸ ਸਟੈਂਡ ਸੀ ਨਾ ਮਤਲਬ ਇੰਨੀ ਟਰੈਫਿਕ ਨਹੀਂ ਹੁੰਦੀ ਸੀ ਹੁਣ ਤਾਂ ਉੱਥੇ ਦੂਰ ਕਰਕੇ ਬਹੁਤ ਟਰੈਫਿਕ ਹੋਣ ਲੱਗ ਗਈ ਇੱਕ ਦੂਰ ਬਹੁਤ ਪੈਂਦਾ ਇਹ ਹੋਰ ਕੀ ਤੁਹਾਨੂੰ ਕੀ ਪਤਾ ਮੈਂ ਇੰਨੀ ਦੇਰ ਦੀ ਚੜੀ ਹੋਈ ਸੀਗੀ ਹੁਣ ਪਹੁੰਚੀ ਆ ਫਿਰ ਘਰ ਵੀ ਤੁ ਤੁਹਾਨੂੰ ਪਤਾ ਆਉਂਦੇ ਆਉਂਦੇ ਵੀ ਇੰਨੇ ਟਰੈਫਿਕ ਮਿਲਦੀ ਆ ਨਾ ਬੱਤੀ ਇੱਕ ਇੱਕ ਥਾਂ ਥਾਂ 'ਤੇ ਬੱਤੀਆਂ ਬਹੁਤ ਨੇਗੀਆਂ ਕਿ ਹੁਣ ਤਾਂ ਹੁਣ ਤਾਂ ਨਵੇਂ ਬੱਸ ਸਟੈਂਡ ਤੋਂ ਮਤਲਬ ਬਸ ਲਓ ਤਾਂ ਲੀਲਾ ਭਵਨ ਹੀ ਉਤਾਰ ਦੀ ਆ ਔਰ ਲੀਲਾ ਭਵਨ ਜੋ ਭੀੜ ਹੁੰਦੀ ਆ ਦੇਖਣ ਵਾਲੀ ਹੁੰਦੀ ਆ ਬਹੁਤ ਭੀੜ ਹੁੰਦੀ ਆ ਹੋਰ ਕੀ ਜੋਬ 'ਤੇ ਰੋਜ਼ ਲੇਟ ਹੋਈ ਜਾਂਦਾ ਜਾਣ ਲੱਗੇ ਵੀ ਇੰਨਾ ਟਰੈਫਿਕ ਮਿਲਦਾ ਅੱਗੇ ਘਰ ਆਉਣ ਲੱਗੇ ਵੀ ਇੰਨਾ ਟਰੈਕਿੰਗ ਮਿਲਦਾ ਇੱਕ ਠੰਡ ਦਾ ਮੌਸਮ ਹੋ ਗਿਆ ਹੈ ਨਾ ਅਤੇ ਬਹੁਤ ਦਿੱਕਤ ਆਉਂਦੀ ਹੈ ਹਾਂਜੀ ਛੋਟੇ ਛੋਟੇ ਦਿਨਾਂ ਕਰਕੇ ਹੀ ਤਾਂ ਮਤਲਬ ਲੇਟ ਵੀ ਹੋ ਜਾਂਦੇ ਇੱਕ ਟਰੈਫਿਕ ਬਹੁਤ ਹੁੰਦੀ ਹੈ ਹਾਂਜੀ ਕਿ ਓਹੀ ਹੁੰਦਾ ਨਾ ਸਵੇਰੇ ਟਰੈਫਿਕ ਸੋਚਦੇ ਹੋਏ ਵੀ ਐਂ ਕਰਦਾ ਕਿ ਬੰਦੇ ਨੂੰ ਕਿ ਹੁਣੇ ਹੀ ਜਲਦੀ ਤੋਂ ਜਲਦੀ ਨਿਕਲ ਲਈਏ ਅੱਗੇ ਜਾ ਕੇ ਟਰੈਫਿਕ ਹੀ ਮਿਲਣਾ ਹਾਂਜੀ ਚਲੋ ਮੈਂ ਘਰ ਪਹੁੰਚੀ ਸੀ ਹੁਣ ਚਲੋ ਮੈਂ ਤੁਹਾਨੂੰ ਫਰੀ ਹੋ ਕੇ ਗੱਲ ਕਰਦੀ ਹਾਂ ਹਾਂਜੀ ਚਲੋ ਠੀਕ ਹੈ ਓਕੇ